ਸਾਡੇ ਖੇਤਰ ਵਿੱਚ ਜ਼ਿਆਦਾਤਰ ਪੰਜਾਬੀ ਬੋਲੀ ਜਾਂਦੀ ਹੈ ਅਤੇ ਪੰਜਾਬੀ ਭਾਸ਼ਾ ਤੋਂ ਇਲਾਵਾ ਹੋਰ ਜਿਹੜੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਉਹ ਹੈ ਹਿੰਦੀ ਡੋਗਰੀ ਅਤੇ ਬਸ ਕਿਉਂਕਿ ਸਾਡੇ ਜਿਹੜੇ ਪਠਾਨਕੋਟ ਦੇ ਖੇਤਰ ਹੈਗਾ ਇਸ ਦੇ ਨਾਲ ਹਿਮਾਚਲ ਅਤੇ ਜੰਮੂ ਕਸ਼ਮੀਰ ਦਾ ਬਾਰਡਰ ਲੱਗਦਾ ਹੈ ਇਸ ਕਰਕੇ ਲੋਕ ਕੁਝ ਲੋਕ ਇੱਧਰ ਆਉਂਦੇ ਹਨ ਪੰਜਾਬ ਦੇ ਵਿੱਚ ਕੰਮ ਕਰਨ ਜਾਂ ਪੰਜਾਬ ਵਾਲੇ ਲੋਕ ਜੰਮੂ ਕਸ਼ਮੀਰ 'ਚ ਕੰਮ ਕਰਦੇ ਹਨ ਇਸ ਕਰਕੇ ਬਾਰਡਰ ਏਰੀਆ ਹੋਣ ਕਰਕੇ ਇੱਥੇ ਇਹ ਭਾਸ਼ਾਵਾਂ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ ਕਈ ਲੋਕ ਜਿਹੜੇ ਕੰਮ ਕਰਦੇ ਹਨ ਦੂਸਰੇ ਸਟੇਟਾਂ ਦੇ ਵਿੱਚ ਜਿਵੇਂ ਹਿਮਾਚਲ ਜਾਂ ਜੰਮੂ ਕਸ਼ਮੀਰ ਦੇ ਵਿੱਚ ਉਹਨਾਂ ਨੂੰ ਇੱਕ ਹੋਰ ਭਾਸ਼ਾ ਸਿੱਖਣ ਨਾ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਉਹ ਕੰਮ ਦੂਸਰੇ ਸਟੇਟ 'ਚ ਕੰਮ ਕਰਨਾ ਉੱਥੇ ਦੀ ਜੇ ਭਾਸ਼ਾ ਬੋਲਣਗੇ ਜਾਂ ਆਉਂਦੀ ਹੋਏਗੀ ਤਾਂ ਉਹਨਾਂ ਦੇ ਲਈ ਫਾਇਦਾ ਹੋਏਗਾ ਜਾਂ ਉਹਨਾਂ ਨੂੰ ਕੰਮ ਕਰਨ ਵਿੱਚ ਆਸਾਨੀ ਹੋਏਗੀ ਇਸ ਕਰਕੇ ਸਾਡੇ ਇੱਧਰ ਦੇ ਕਈ ਲੋਕ ਇਹ ਦੂਸਰੀਆਂ ਭਾਸ਼ਾਵਾਂ ਸਿੱਖਦੇ ਹਨ ਅਤੇ ਜਿਹੜਾ ਨੌਜਵਾਨ ਹੈ ਉਹ ਆਪਣੀ ਮਾਂ ਬੋਲੀ ਵਿੱਚ ਗੱਲ ਕਰਨਾ ਹੀ ਪਸੰਦ ਕਰਦਾ ਹੈ ਅਤੇ ਪੰਜਾਬੀ ਭਾਸ਼ਾ ਬੋਲਣ ਵਿੱਚ ਹੀ ਮਾਣ ਮਹਿਸੂਸ ਕਰਦੇ ਹਨ